ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਆਹ ਜੱਗੀ ਸਵੀਟਸ ਹਾਊਸ ਤੋਂ ਬੋਲ ਰਹੇ ਹੋ ਜੀ ਭਾਅ ਜੀ ਅਸੀਂ ਨਾ ਭਾਅ ਜੀ ਖਾਣੇ ਦਾ ਆਰਡਰ ਕੀਤਾ ਸੀਗਾ ਉਹਦੇ ਵਿੱਚ ਦਾਲ ਮੱਖਣੀ ਸੀਗੀ ਇੱਕ ਫੁਲਕੇ ਸੀਗੇ ਅਤੇ ਮਿੱਠੇ ਵਿੱਚ ਗੁਲਾਬ ਜਾਮੁਨਾਂ ਮੰਗਵਾਈਆਂ ਸੀਗੀਆਂ ਪਰ ਜਦੋਂ ਅਸੀਂ ਆਡਰ ਕੀਤਾ ਤਾਂ ਜਿਹੜਾ ਡਿਲੀਵਰੀ ਬੋਆਏ ਸੀ ਉਹਨੂੰ ਵਾਰ ਵਾਰ ਫੋਨ ਕੀਤਾ ਸੀਗਾ ਕਿ ਸਾਡਾ ਔਡਰ ਜਲਦੀ ਮੰਗਾ ਦਿਉ ਪਰ ਉਹ ਸਾਡਾ ਨਾ ਫੋਨ ਨਹੀਂ ਪਿੱਕ ਕਰ ਰਿਹਾ ਇਸ ਲਈ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਉਸ ਨਾਲ ਸੰਪਰਕ ਕਰ ਲਿੱਤਾ ਜਾਵੇ ਸਾਡੇ ਘਰ ਗੈਸਟ ਆਏ ਹੋਏ ਆ ਤਾਂ ਜੋ ਕਿ ਜਲਦੀ ਤੋਂ ਜਲਦੀ ਸਾਨੂੰ ਖਾਣਾ ਮਿਲ ਸਕੇ ਇਸ ਦਾ ਅਪਡੇਟ ਕਰਕੇ ਕਿਰਪਾ ਕਰਕੇ ਸਾਨੂੰ ਜਲਦੀ ਤੋਂ ਜਲਦੀ ਦੱਸ ਦਿੱਤਾ ਜਾਵੇ